ਹਾਂ ਮੈਂ ਆਪਣੇ ਪ੍ਰਦਰਸ਼ਨ ਨੂੰ ਬਿਹਤਰ ਕਰਨ ਲਈ ਜੀ ਪੀ ਐੱਸ ਘੜੀ ਦਾ ਇਸਤੇਮਾਲ ਕਰਦਾ ਹਾਂ ਜੋ ਕਿ ਸੋਨੀ ਕੋਪਨੀ ਦੀ ਹੈ ਜਦੋਂ ਮੈਂ ਟਰੈਕ ਕਰਦਾ ਹਾਂ ਆਪਣੇ ਆਪ ਨੂੰ ਜਾਂ ਟਰੈਕ 'ਤੇ ਚੱਲਦਾ ਹਾਂ ਤਾਂ ਜੀ ਪੀ ਐੱਸ ਘੜੀ ਮੈਨੂੰ ਦੱਸਦੀ ਹੈ ਕਿ ਮੈਂ ਕਿੰਨੇ ਕਿਲੋਮੀਟਰ ਚੱਲ ਗਿਆ ਹਾਂ ਅਤੇ ਕਿੰਨੇ ਟਾਈਮ ਵਿੱਚ ਕਿਲੋਮੀਟਰ ਮੈਂ ਕੱਢਿਆ ਹੈ ਇਸ ਪ੍ਰਕਾਰ ਮੈਨੂੰ ਰੋਜ਼ਾਨਾ ਪਤਾ ਚੱਲਦਾ ਰਹਿੰਦਾ ਹੈ ਅਤੇ ਮੈਂ ਜੀ ਪੀ ਐੱਸ ਘੜੀ ਦੇ ਨਾਲ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ ਅਤੇ ਰੋਜ਼ਾਨਾ ਮੈਂ ਆਪਣੇ ਟੀਚੇ ਵਿੱਚ ਅਸਟੈਂਡਰਡ ਜੋ ਸੈੱਟ ਕੀਤਾ ਹੈ ਉਸਨੂੰ ਅਚੀਵ ਕਰਨ ਵਾਸਤੇ ਆਪਣੀ ਯੋਜਨਾ ਟ੍ਰੇਨਿੰਗ ਪ੍ਰੋਗਰਾਮ ਦੇ ਮੁਤਾਬਿਕ ਬਣਾਉਂਦਾ ਰਹਿੰਦਾ ਹਾਂ ਔਰ ਮੈਂ ਡੇਲੀ ਜੀ ਪੀ ਐੱਸ ਘੜੀ ਦੇ ਮੁਤਾਬਿਕ ਚੱਲਦਾ ਰਹਿੰਦਾ ਹਾਂ